ਹਾਂਜੀ ਮੈਮ ਹਾਂਜੀ ਗੁਡ ਮੋਰਨਿੰਗ ਗੁਡ ਈਵਨਿੰਗ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੁਹਾਡੇ ਮਾਰਕਸ ਬਹੁਤ ਵਧੀਆ ਆਏ ਨੇਗੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਨੰਬਰ ਲੈਤੇ ਨੇ ਪਰ ਹੋਰ ਅਗਰ ਜ਼ਿਆਦਾ ਥੋੜ੍ਹੀ ਜਿਹੀ ਹੋਰ ਮਿਹਨਤ ਕਰ ਲੈਂਦੇ ਤਾਂ ਵੱਧ ਵਧੀਆ ਨੰਬਰ ਆਉਣੇ ਸੀ ਹਾਂਜੀ ਹਾਂਜੀ ਜ਼ਰੂਰ ਬੇਟੇ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਟੈਂਨਥ ਕਲਾਸ ਆ ਜਿਹੜੀ ਬੋਰਡ ਦੀ ਕਲਾਸ ਹੁੰਦੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਕਿ ਤੇਰੇ ਨੰਬਰ ਘਟਣ ਦਾ ਕਾਰਨ ਇਹੀ ਆ ਇੱਕ ਤਾਂ ਪੇਪਰਾਂ ਦੇ ਟਾਈਮ ਤੂੰ ਘੱਟ ਮਿਹਨਤ ਕੀਤੀ ਆ ਬਾਕੀ ਤੇਰੇ ਮੰਥਲੀ ਇਗਜ਼ਾਮ 'ਚੋਂ ਵਧੀਆ ਚੱਲੇ ਸੀਗੇ ਉਹਨਾਂ ਦੇ ਵਿੱਚ ਤਾਂ ਤੇਰੇ ਵਧੀਆ ਨੰਬਰ ਆਏ ਹੋਏ ਨੇ ਪਰ ਫਾਈਨਲ ਪੇਪਰਾਂ ਦੇ ਵਿੱਚੋਂ ਪਤਾ ਨਹੀਂ ਤੈਨੂੰ ਕੀ ਹੋਇਆ ਪੰਜਾਬੀ 'ਚ ਵੀ ਘੱਟ ਨੰਬਰ ਲਿਤੇ ਨੇ ਅਤੇ ਥੋੜ੍ਹੇ ਜਿਹੇ ਹਿਸਾਬ ਦੇ ਵਿੱਚੋਂ ਵੀ ਨੰਬਰ ਘੱਟ ਆਏ ਨੇਗੇ

ਗਲਤੀਆਂ ਬਹੁਤ ਨੇ ਬੇਟੇ ਪੰਜਾਬੀ ਲਿਖਣ ਦੇ ਵਿੱਚ ਨਾ ਕਾਫੀ ਜ਼ਿਆਦਾ ਹਾਂਜੀ ਹਾਂਜੀ ਬੇਟੇ ਤੁਸੀਂ ਦੱਸੋਗੇ ਤਾਂ ਹੀ ਪਤਾ ਲੱਗੂ ਨਾ ਟੀਚਰ ਵੀ ਤਾਂ ਹੀ ਹੈਲਪ ਕਰੇਗਾ ਜੇ ਤੁਸੀਂ ਆਪ ਗੱਲ ਕਰੋਗੇ ਹਾਂ ਨਾ ਬੱਚੇ ਬੇਟੇ ਥੋੜ੍ਹਾ ਜਿਹਾ ਮੈਥ ਕੰਪਲੀਕੇਟਡ ਸਬਜੈਕਟ ਆ ਪਰ ਲੇਕਿਨ ਇਹ ਵਾਰ ਵਾਰ ਪ੍ਰੈਕਟਿਸ ਕਰੋਗੇ ਨਾ ਸਵਾਲਾਂ ਨੂੰ ਜਿੰਨੇ ਸਵਾਲ ਉਹ ਕਢਵਾਉਂਦੇ ਨੇ ਜੇ ਵਾਰ ਵਾਰ ਉਹਨਾਂ ਨੂੰ ਘਰ ਜਾ ਕੇ ਕੱਢੋਗੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਨਹੀਂ ਕਿ ਤੁਹਾਨੂੰ ਸਮਝ ਨਹੀਂ ਲੱਗੂ ਅਤੇ ਦੂਸਰੀ ਗੱਲ ਹੈ ਕਿ ਤੁਸੀਂ ਮੈਥ ਦੇ ਵਿੱਚ ਇੰਟਰਸਟ ਘੱਟ ਲੈ ਰਹੇ ਹੋ ਜਿੰਨਾ ਕੁ ਤੁਹਾਨੂੰ ਸਰ ਸਵਾਲ ਕਰਵਾਉਂਦੇ ਨੇ ਸਰ ਕਰਵਾਉਂਦੇ ਨੇ ਇੱਕ ਤਾਂ ਉਹਨਾਂ ਨੂੰ ਘਰੋਂ ਕੱਢ ਕੇ ਆਉ ਜੇ ਕੋਈ ਨਹੀਂ ਸਮਝ ਆਉਂਦਾ ਤਾਂ ਆਪਣਾ ਆ ਕੇ ਸਰ ਦੇ ਕੋਲ ਬੈਠ ਕੇ ਡਾਊਟ ਕਲੀਅਰ ਕਰੋ ਵੀ ਜੀ ਸਾਨੂੰ ਇਹ ਸਵਾਲ ਸਮਝ ਨਹੀਂ ਲੱਗਿਆ ਨਿਸ਼ਾਨੀ ਜ਼ਰੂਰ ਲਗਾ ਕੇ ਲੈ ਕੇ ਆਇਆ ਕਰੋ ਜੇ ਜੇ ਉਹ ਇੱਕ ਸਵਾਲ ਕਢਵਾਉਂਦੇ ਨੇ ਉਹਦੇ ਨਾਲ ਦੇ ਤਿੰਨ ਜਾਂ ਚਾਰ ਸਵਾਲ ਤੁਸੀਂ ਆਪ ਸੋਲਵ ਕਰੋਂਗੇ ਵੱਧ ਟਾਈਮ ਲਗਾਓ ਬਾਕੀ ਸਬਜੈਕਟਾਂ ਦੇ ਨਾਲੋਂ ਜਿਸ ਤਰ੍ਹਾਂ ਹਿੰਦੀ ਆ ਹਿੰਦੀ ਦੇ ਵਿੱਚੋਂ ਤੁਹਾਡੇ ਵਧੀਆ ਨੰਬਰ ਆਏ ਹੋਏ ਨੇ ਲੇਕਿਨ ਥੋੜ੍ਹਾ ਇੰਗਲਿਸ਼ ਦੇ ਵਿੱਚ ਵੀ ਥੋੜ੍ਹੀਆਂ ਜਿਹੀਆਂ ਤੁਹਾਡੀ ਗ੍ਰਾਮਰ ਆ ਜਿਹੜੀ ਵੀਕ ਆ ਗਰਾਮਰ ਦੇ ਵਿੱਚ ਸਾਡਾ ਤੁਹਾਨੂੰ ਦੇਣ ਦੀ ਜ਼ਰੂਰਤ ਆ ਧਿਆਨ ਦੇਵੋ ਮੈਥ ਦੇ ਸਰ ਤੁਸੀਂ ਥੋੜ੍ਹਾ ਜਿਹਾ ਹਾਂ ਬੇਟੇ ਜ਼ਰੂਰ ਸਗੋਂ ਜੀ ਸਾਨੂੰ ਹੁੰਦਾ ਵੀ ਬੱਚਾ ਕਹੇ ਸਾਨੂੰ ਵੀ ਮੈਨੂੰ ਵੱਧ ਕੰਮ ਦੇਵੋ ਜੀ ਨਹੀਂ ਤਾਂ ਬੱਚਿਆਂ ਨੂੰ ਜ਼ਿਆਦੇ ਆਂਈਂ ਹੁੰਦਾ ਵੀ ਅਸੀਂ ਤਾਂ ਨਾਨਕੇ ਚਲੇ ਜਾਈਏ ਅਸੀਂ ਇੱਧਰ ਉੱਧਰ ਘੁੰਮਣ ਚਲੇ ਜਾਈਏ ਵੀ ਸਾਨੂੰ ਕੰਮ ਕਿਉਂ ਦਿੱਤਾ ਬੱਚੇ ਤਾਂ ਬਹੁਤ ਜ਼ਿਆਦਾ ਵੀ ਬਰਡਨ ਮਹਿਸੂਸ ਕਰਨ ਲੱਗ ਜਾਂਦੇ ਨੇ ਜਦੋਂ ਅਸੀਂ ਥੋੜ੍ਹਾ ਜਿਹਾ ਵੀ ਕੰਮ ਦਿੰਦੇ ਹਾਂ ਸਗੋਂ ਦੀ ਇਹ ਟਾਈਮ ਉਹ ਹੁੰਦਾ ਕਿ ਜਿਹੜੀਆਂ ਆਪਣੀ ਵੀਕ ਪੁਆਇੰਟ ਨੇ ਆਪਾਂ ਇਹਨਾਂ ਨੂੰ ਕਵਰ ਕਰ ਲਈਏ ਜਿੰਨਾ ਕੁ ਆਪਣਾ ਸਿਲੇਬਸ ਰਹਿੰਦਾ ਜ਼ਰੂਰ ਬੇਟੇ ਹਾਂ ਬਾਕੀ ਬੇਟਾ ਦੇਖੋ ਤੁਸੀਂ ਸਾਇੰਸ ਦੇ ਵਿੱਚੋਂ ਬਹੁਤ ਵਧੀਆ ਨੰਬਰ ਲਿੱਤੇ ਨੇਗੇ ਬਹੁਤ ਅੱਛੇ ਨੰਬਰ ਨੇ ਤੁਹਾਡੇ ਪਚਾਸੀ ਪ੍ਰਸੈਂਟ ਨੰਬਰ ਸਾਇੰਸ ਦੇ ਵਿੱਚੋਂ ਆਏ ਹੋਏ ਨੇਗੇ ਅਤੇ ਨਾਲ ਹੀ ਤੁਸੀਂ ਦੇਖੋ ਕੰਪਿਉਟਰ ਸਾਇੰਸ ਦੇ ਵਿੱਚੋਂ ਹਾਂ ਬੱਚੇ ਉਹ ਕੋਈ ਗੱਲ ਨਹੀਂ ਤੁਸੀਂ ਮਿਹਨਤ ਕਰੋ ਦੇਖੋ ਤੁਹਾਡੇ ਉੱਪਰ ਵੀ ਬਹੁਤ ਬੱਚਿਆਂ ਦੇ ਦੇਖੋ ਨਾਈਨਟੀ ਫਾਈਵ ਪ੍ਰਸੈਂਟ ਆਏ ਨੇ ਨਾਈਨਟੀ ਏਟ ਪਰਸੈਂਟ 'ਤੇ ਵੀ ਬੱਚੇ ਬੈਠੇ ਨੇ ਨਾਈਨਟੀ 'ਤੇ ਵੀ ਬੱਚੇ ਨੇ ਨਾਈਨਟੀ ਟੂ 'ਤੇ ਵੀ ਨੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਤੁਸੀਂ ਥੋੜ੍ਹੇ ਜਿਹੇ ਪਿੱਛੇ ਰਹਿ ਗਏ ਪਰ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਹੋਰ ਕਰਨੀ ਪਊਗੀ ਦੇਖੋ ਕੰਪਿਊਟਰ ਸਾਇੰਸ 'ਚੋਂ ਵੀ ਤੁਸੀਂ ਏ ਪਲੱਸ ਗਰੇਡ ਲਿੱਤਾ ਸਰੀਰਕ 'ਚੋਂ ਵੀ ਤੁਹਾਡਾ ਏ ਪਲੱਸ ਗਰੇਡ ਆਇਆ ਓਵਰਆਲ ਦੇਖੋ ਤੁਸੀਂ ਏ ਪਲਸ ਗ੍ਰੇਡ ਲਿਤਾ ਹੋਇਆ ਖੇਡਾਂ ਦੇ ਵਿੱਚ ਵੀ ਤੁਹਾਡਾ ਵਧੀਆ ਪਰਫੋਰਮੈਂਸ ਦਿੱਤੀ ਹੋਈ ਹੈ ਤੁਸੀਂ ਫਿਜੀਕਲ ਦੇ ਵਿੱਚੋਂ ਵੀ ਵਧੀਆ ਨੰਬਰ ਲਿੱਤੇ ਨੇਗੇ ਏ ਪਲੱਸ ਗਰੇਡ ਆਇਆ ਉੱਥੇ ਵੀ ਤੁਹਾਡਾ ਥੋੜ੍ਹਾ ਜਿਹਾ ਤੁਸੀਂ ਇਸ ਤਰ੍ਹਾਂ ਵੀ ਕਰੋ ਵੀ ਜੇ ਕੋਈ ਕਿਸੇ ਗੇਮ ਕਰਨੀ ਥੋੜ੍ਹਾ ਇੰਟਰਸਟ ਆ ਉਹ ਆਪਣਾ ਇੰਟਰਸਟ ਕ੍ਰੀਏਟ ਕਰੋ ਬਾਕੀ ਜੇ ਹਾਂ ਬੇਟਾ ਤੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੇਗਾ ਇਹਦੇ ਨਾਲ ਹੀ ਤੁਹਾਡੇ ਪਰਿਵਾਰ ਦਾ ਵੀ ਨਾਮ ਰੋਸ਼ਨ ਹੋਊ ਤੁਹਾਡੇ ਮਾਤਾ ਪਿਤਾ ਦੇਖੋ ਕਿੰਨੀ ਮਿਹਨਤ ਕਰ ਕਰਕੇ ਫੀਸਾਂ ਭਰਦੇ ਨੇ ਬੱਚੇ ਉਹਨਾਂ ਦੀ ਮਿਹਨਤ ਦਾ ਤਾਂ ਜ਼ਰੂਰ ਮੁੱਲ ਪਾਓ ਤੁਸੀਂ ਦੇਖੋ ਆਪ ਉਹ ਤੁਹਾਨੂੰ ਸਵੇਰੇ ਤਿਆਰ ਕਰਕੇ ਦੇਖੋ ਸਕੂਲੇ ਭੇਜਦੇ ਨੇਗੇ ਕਿੰਨੀ ਮਿਹਨਤ ਕਰ ਰਹੇ ਨੇ ਸਿਰਫ ਤੁਹਾਡੇ ਲਈ ਕਰ ਰਹੇ ਨੇ ਜੇ ਤੁਸੀਂ ਵਧੀਆ ਉਹਨਾਂ ਨੂੰ ਰਿਜਲਟ ਦੇਵੋਗੇ ਤਾਂ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਅੱਗੇ ਵੱਧਦੇ ਨੇ ਦੇਖੋ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕਰੋ ਆਪਾਂ ਤਾਂ ਇਹੀ ਕਹਿੰਦੇ ਹਾਂ ਵਾਰ ਵਾਰ ਅਤੇ ਤੁਸੀਂ ਵਧੀਆ ਵਧੀਆ ਜੋਬ ਕਰੋ ਕਿਉਂਕਿ ਅੱਜ ਕੱਲ ਦੇਖੋ ਕੰਪੀਟੀਸ਼ਨ ਦਾ ਜ਼ਮਾਨਾ ਬਿਨਾਂ ਪੜ੍ਹਾਈ ਤੋਂ ਤਾਂ ਕੁਝ ਵੀ ਨਹੀਂ ਤੁਹਾਡੇ ਕੋਲ ਬਣਨਾ ਹੈਗਾ ਤੁਹਾਨੂੰ ਪੜ੍ਹਨਾ ਹੀ ਪਊਗਾ ਹਾਂ ਮਨ ਹਾਂ ਮਨ ਲਗਾ ਕੇ ਪੜ੍ਹੋਗੇ ਬਹੁਤ ਵਧੀਆ ਨੰਬਰ ਆਉਣਗੇ ਕਿਤੇ ਵੀ ਤੁਹਾਨੂੰ ਸਮਝ ਨਹੀਂ ਆਉਂਦਾ ਨਾ ਤੁਸੀਂ ਨਾਲ ਦੀ ਨਾਲ ਜਾਂ ਤਾਂ ਸਾਡੇ ਕੋਲ ਆਓ ਵੀ ਜੇ ਕੋਈ ਟੀਚਰ ਤੁਹਾਡੀ ਨਹੀਂ ਹੈਲਪ ਦਿੰਦਾ ਬੇਟੇ ਜਿੰਨਾ ਅਸੀਂ ਸਕੂਲੇ ਕੰਮ ਕਰਵਾ ਦਿੰਦੇ ਹਾਂ ਅਗਰ ਤੁਹਾਨੂੰ ਇੱਕ ਲੈਸਨ ਕਰਵਾਇਆ ਉਹਦੇ ਚਾਰ ਕੁਸ਼ਚਨ ਵੀ ਕਰਵਾਏ ਨੇ ਉਹੀ ਚਾਰ ਕੁਸ਼ਚਨ ਜੇ ਤੁਸੀਂ ਘਰ ਬੈਠ ਕੇ ਵੀ ਤਿਆਰ ਕਰ ਲੈਂਦੇ ਹੋ ਤਾਂ ਸਾਨੂੰ ਤਾਂ ਨਹੀਂ ਲੱਗਦਾ ਕਿ ਤੁਹਾਨੂੰ ਟਿਊਸ਼ਨ ਦੀ ਲੋੜ ਪਊ ਤੁਹਾਡੇ ਬਹੁਤ ਵਧੀਆ ਮਾਕਸ ਕਹਿ ਸਕਦੇ ਹਾਂ ਹਾਂ ਕਿਤੇ ਵੀ ਨਹੀਂ ਸਮਝ ਲੱਗਦੀ ਬੇਟੇ ਉਹਨੂੰ ਚਾਰ ਵਾਰੀ ਪੁੱਛੋ ਪੰਜ ਵਾਰੀ ਪੁੱਛੋ ਅੱਧੀ ਛੁੱਟੀ ਆਓ ਸਾਡੇ ਕੋਲ ਕੋਈ ਗੱਲ ਨਹੀਂ ਅੱਜ ਨਹੀਂ ਸਮਝ ਲੱਗੀ ਕੱਲ ਨੂੰ ਪੁੱਛ ਲਓ ਪਰ ਆਪਣਾ ਜਿਹੜਾ ਡਾਊਟ ਆ ਉਹ ਜ਼ਰੂਰ ਕਲੀਅਰ ਕਰਿਆ ਕਰੋ ਐਵੇਂ ਤਾਂ ਵਿੱਚ ਵਿੱਚ ਨਹੀਂ ਤੁਸੀਂ ਹਾਂਜੀ ਹਾਂ ਬੇਟੇ ਤੁਸੀਂ ਸੋਮਵਾਰ ਆਓ ਆਪਣਾ ਵਿੱਚ ਦੀ ਬੇਟੇ ਤੇਰੀਆਂ ਥੋੜ੍ਹੀਆਂ ਜਿਹੀਆਂ ਛੁੱਟੀਆਂ ਜ਼ਿਆਦਾ ਲੱਗੀਆਂ ਨੇਗੀਆਂ ਦੇਖੋ ਤੁਸੀਂ ਪਤਾ ਨਹੀਂ ਤਾਂ ਆਪਣੇ ਮਾਮਾ ਜੀ ਦੇ ਵਿਆਹ 'ਤੇ ਚਲੇ ਗਏ ਤੇ ਉਹ ਪਿੱਛੇ ਫਿਰ ਤੁਹਾਡੀ

ਹਾਂ ਬੇਟੇ ਦੇਖੋ ਤੁਹਾਡੀ ਬੋਰਡ ਦੀ ਕਲਾਸ ਆ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਆਪਣੇ ਪੇਰੈਂਟਸ ਨੂੰ ਵੀ ਸਮਝਾਓ ਵੀ ਭਾਈ ਇਹ ਤੋਰਾ ਫੇਰਾ ਘੱਟ ਕਰੋ ਅਗਰ ਬੇਟਾ ਉਹ ਜਾਂਦੇ ਵੀ ਨੇ ਉਹਨਾਂ ਨੂੰ ਮਜ਼ਬੂਰੀ ਆ ਕਿਤੇ ਜਾਣਾ ਵੀ ਪੈਂਦਾ ਤਾਂ ਤੁਸੀਂ ਤਾਂ ਆਪਣਾ ਘਰ ਬੈਠ ਕੇ ਪੜ੍ਹ ਸਕਦੇ ਹੋ ਬੜੇ ਬੱਚੇ ਹੋ ਹੁਣ ਹਾਂ ਬੇਟੇ ਤੇਰਾ ਥੋੜ੍ਹਾ ਜਿਹਾ ਪੜ੍ਹਾਈ 'ਚ ਪਿੱਛੇ ਰਹਿਣ ਦਾ ਕਾਰਨ ਵੀ ਇਹੀ ਆ ਵੀ ਤੇਰਾ ਧਿਆਨ ਜਿਹੜਾ ਭਟਕ ਜਾਂਦਾ ਕਦੇ ਨਾਨਕਿਆਂ ਦੇ ਚਲੇ ਜਾਂਦੇ ਆ ਹਾਂ ਠੀਕ ਆ ਬੇਟਾ ਠੀਕ ਆ ਬੇਟਾ ਓਕੇ ਬੇਟਾ ਬੈਸਟ ਆਫ ਲੱਕ